ਹਾਂ ਮੈਂ ਯਾਤਰੀ ਬੱਸਾਂ ਦਾ ਵਰਣਨ ਕਰ ਸਕਦਾ ਹਾਂ ਜਿਵੇਂ ਕਿ ਛੋਟੀ ਬੱਸ ਵੱਡੀ ਬੱਸ ਏ ਸੀ ਵਾਲੀ ਬੱਸ ਸਲੀਪਰ ਬੱਸ ਪਰਸਨਲ ਕੈਬਿਨ ਬੱਸ ਛੋਟੀ ਬੱਸ ਛੋਟੀ ਬੱਸ ਵਿੱਚ ਤੀਹ ਸੀਟਾਂ ਹੁੰਦੀਆਂ ਹਨ ਪੰਦਰਾਂ ਸੀਟਾਂ ਬਾਰੀ ਨਾਲ਼ ਲੱਗੀ ਹੁੰਦੀ ਹੈ ਅਤੇ ਪੰਦਰਾਂ ਸੀਟਾਂ ਉਹਦੇ ਨਾਲ਼ ਲੱਗੀਆਂ ਹੁੰਦੀਆਂ ਹਨ ਵੱਡੀ ਬੱਸ ਵੱਡੀ ਬੱਸ ਵਿੱਚ ਸੱਠ ਸੀਟਾਂ ਹੁੰਦੀਆਂ ਹਨ ਜਿਸ ਵਿੱਚ ਇੱਕ ਡਰਾਈਵਰ ਸੀਟ ਹੁੰਦੀ ਹੈ ਅਤੇ ਬਾਕੀ ਸੀਟਾਂ ਵਿੰਡੋ ਵਾਲੀਆਂ ਅਤੇ ਦੂਜੀਆਂ ਸੀਟਾਂ ਹੁੰਦੀਆਂ ਹਨ ਏ ਸੀ ਵਾਲੀ ਬੱਸ ਏ ਸੀ ਵਾਲੀ ਬੱਸ ਤਾਂ ਬੁੱਕ ਕਰੀਦੀ ਆ ਜਦੋਂ ਜ਼ਿਆਦਾ ਗਰਮੀ ਹੁੰਦੀ ਹੈ ਅਤੇ ਆਪਾਂ ਕਿਸੀ ਇੱਕ ਥਾਂ ਤੋਂ ਦੂਜੀ ਥਾਂ 'ਤੇ ਵੱਡੀ ਯਾਤਰਾ 'ਤੇ ਜਾਣਾ ਹੁੰਦਾ ਹੈ ਏ ਸੀ ਵਾਲੀ ਬੱਸ ਵਿੱਚ ਹਰ ਇੱਕ ਸੀਟ ਦੇ ਉੱਤੇ ਇੱਕ ਛੋਟੀ ਜਿਹੀ ਖਿੜਕੀ ਉੱਤੇ ਏ ਸੀ ਲੱਗਾ ਹੁੰਦਾ ਹੈ ਜਦ ਤੱਕ ਯਾਤਰਾ ਚੱਲਦੀ ਹੈ ਤਦ ਤੱਕ ਏ ਸੀ ਚੱਲਦਾ ਰਹਿੰਦਾ ਹੈ ਸਲੀਪਰ ਬੱਸ ਸਲੀਪਰ ਬੱਸ ਤਾਂ ਬੁੱਕ ਕਰੀਦੀ ਹੈ ਜਦੋਂ ਆਪਾਂ ਕਿਸੀ ਲੰਬੀ ਯਾਤਰਾ 'ਤੇ ਜਾਣਾ ਹੁੰਦਾ ਹੈ ਅਤੇ ਸਲੀਪਰ ਬੱਸ ਵਿੱਚ ਸਾਨੂੰ ਸੌਣ ਬਾਰੇ ਸੌਣ ਦਿੱਤਾ ਜਾਂਦਾ ਹੈ ਅਤੇ ਜਦੋਂ ਮੈਂ ਯਾਤਰਾ ਕੀਤੀ ਸੀ ਉਹ ਟਾਈਮ ਮੈਂ ਸਲੀਪਰ ਬੱਸ ਬੁੱਕ ਕੀਤੀ ਸੀ ਇਸ ਵਿੱਚ ਇੱਕ ਕੰਬਲ ਦਿੱਤਾ ਜਾਂਦਾ ਅਤੇ ਗੱਦੇ ਬੜੇ ਮੁਲਾਇਮ ਹੁੰਦੇ ਹਨ ਇਸ ਵਿੱਚ ਅਤੇ ਇਸ ਵਿੱਚ ਕੋਈ ਅਨਕੰਫਟੇਬਲ ਫੀਲ ਨਹੀਂ ਹੁੰਦਾ ਇਸ ਵਿੱਚ ਬੜੀ ਥਾਂ ਹੁੰਦੀ ਹੈ ਇੱਕ ਪਰਸਨ ਦੇ ਸੌਣ ਵਾਸਤੇ ਇਹਦੇ ਅੰਦਰ ਸੱਠ ਸੀਟਾਂ ਹੁੰਦੀਆਂ ਹਨ ਅਤੇ ਉਹਦੇ ਉੱਤੇ ਸੌਣ ਦੇ ਅਰੇਂਜਮੈਂਟ ਦਿੱਤੇ ਚ ਦਿੱਤੇ ਹੁੰਦੇ ਹਨ